ਅਤੇ ਕੁ ਐਂ ਨਹੀਂ ਵੀ ਹਾਂ ਵੀ ਕੋਈ ਜ਼ਿੱਦ ਕਰਦਾ ਮਾਰਦੇ ਨਹੀਂ ਜੀ ਵਧੀਆ ਸਮਝਾਉਂਦੇ ਐਨ ਤਰੀਕੇ ਨਾਲ ਅਤੇ ਗਰੀਬ ਦੇ ਗਰੀਬ ਨਾਲ ਖੜ੍ਹਦੇ ਵੀ ਟੀਚਰ ਅਤੇ ਜਿਹੜੇ ਕੋਲਜ ਆ ਕੋਲਜਾਂ ਵਿੱਚ ਵੀ ਬਹੁਤ ਵਧੀਆ ਪੜ੍ਹਾਈ ਆ ਜੀ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਉਹ ਕਰਿਆ ਹੋਇਆ ਜੀ ਸਮਝਾਉਂਦੇ ਆ ਜਿਵੇਂ ਹੁਣ ਅਸੀਂ ਬੜੇ ਹੋ ਗਏ ਜੀ ਹੁਣ ਜੋਬ ਕਰਦੇ ਹਾਂ ਜੀ ਅਸੀਂ ਕੋਲਜਾਂ ਵਿੱਚ ਮੈਂ ਕੋਲਜ ਵਿੱਚ ਲੱਗਿਆ ਹੋਇਆ ਜੀ ਹੁਣ ਕੰਮ ਕਰਦਾ ਜੀ ਜੋਬ ਕਰ ਰਿਹਾ ਦੋ ਮੇਰੇ ਕੋਲ ਦੋ ਬੱਚੇ ਆ ਜੀ ਮੈਂ ਵੀ ਹੁਣ ਵੀ ਮਤਲਬ ਵੀ ਵਧੀਆ ਤੋਂ ਵਧੀਆ ਸਕੂਲ ਵਿੱਚ ਲਾ ਕੇ ਪੜਾਉਂਗਾ ਜੀ ਬਹੁਤ ਵਧੀਆ ਤਰੀਕੇ ਨਾਲ ਇਹ ਪੜਾਉਂਦੇ ਆ ਜੀ